ਹਾਂਜੀ ਇਹ ਤਾਂ ਬਹੁਤ ਵਧੀਆ ਕੁਸ਼ਚਨ ਤੁਸੀਂ ਮੇਰੇ ਕੋਲੋਂ ਪੁੱਛਿਆ ਹੈਗਾ ਵੀ ਜਿਹੜਾ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਮਹੱਤਵਪੂਰਨ ਹੈ ਜਾਂ ਨਹੀਂ ਹੈ ਜੀ ਬਿ ਬਿਲਕੁਲ ਹੈਗਾ ਗਾ ਮਹੱਤਵਪੂਰਨ ਜੇ ਬੱਚੇ ਆਪਣੀ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਜੇ ਬੱਚੇ ਆਪਣੀ ਮਾਂ ਬੋਲੀ ਨੂੰ ਨਹੀਂ ਸਿੱਖਣਗੇ ਤਾਂ ਫਿਰ ਉਹ ਕਰਨਗੇ ਕੀ ਹੈ ਨਾ ਵੀ ਅੱਜ ਕੱਲ੍ਹ ਤਾਂ ਜਿਹੜੀ ਪੰਜਾਬੀ ਭਾਸ਼ਾ ਹੈਗਾ ਜਿਹੜੀ ਸਿੱਖਣੀ ਬਹੁਤ ਜ਼ਰੂਰੀ ਹੋ ਗਈ ਆਹ ਪਿੱਛੇ ਜਿਹੇ ਸੀਗਾ ਜਿਹੜੇ ਅੰਗਰੇਜ਼ੀ ਸਕੂਲਾਂ ਵਾਲੇ ਹੈਗੇ ਪੰਜਾਬੀ ਜਮਾ ਹੀ ਨਹੀਂ ਪੜ੍ਹਾਉਂਦੇ ਸੀ ਸਰਕਾਰ ਨੇ ਵੀ ਐਤਕੀ ਤਾਂ ਹਦਾਇਤਾਂ ਜਾਰੀ ਕਰਤੀਆਂ ਨਾ ਵੀ ਹਰ ਇੱਕ ਨੂੰ ਜਿਹੜਾ ਕਿ ਹੈਗਾ ਜਿਹੜੀ ਆਪਣੀ ਤੁਹਾਡੀ ਮਾਤ ਭਾਸ਼ਾ ਹੈਗੀ ਤੁਹਾਨੂੰ ਸਕੂਲ ਦੇ ਵਿੱਚ ਸਿਖਿਆਊ ਸਿਖਾਈ ਜਾਊਗੀ ਹੁਣ ਤਕੜੇ ਤਕੜੇ ਜਿਹੜੇ ਵੀ ਸਕੂਲ ਆ ਇੰਟਰਨੈਸ਼ਨਲ ਸਕੂਲ ਹੈ ਉਹਨਾਂ ਵਿੱਚ ਵੀ ਪੰਜਾਬੀ ਦੀ ਜਿਹੜੀ ਪੰਜਾਬ ਬੋਰਡ ਵੱਲੋਂ ਜਿਹੜੀ ਬੁੱਕ ਤਿਆਰ ਕਰਵਾਈ ਗਈ ਆ ਉਹ ਪੜ੍ਹਾਈ ਜਾਣ ਲੱਗ ਗਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਬੱਚੇ ਤਾਂ ਜਿਵੇਂ ਘਰ ਬਿੱਲੀ ਫਿਰਦੀ ਹੈ ਬਿੱਲੀ ਨੂੰ ਬਿੱਲੀ ਨਹੀਂ ਕਹਿੰਦੇ ਕੈਟ ਕਹਿੰਦੇ ਆ ਡੋਗ ਨੂੰ ਕੁੱਤਾ ਨਹੀਂ ਕਹਿੰਦੇ ਉਹਨੂੰ ਡ ਡੋਗ ਹੀ ਚੱਲਦਾ ਕੇ ਨਾ ਅੰਗਰੇਜ਼ੀ ਵਰਤਣ ਲੱਗ ਗਏ ਘਰ ਵੀ ਪਤੰਦਰ ਤਾਂ ਪੰਜਾਬੀ ਜਿਹੜੀ ਭਾਸ਼ਾ ਹੈਗੀ ਉੱਦਾਂ ਤਾਂ ਦੇਖੋ ਪੇਰੈਂਟਸ ਨੂੰ ਵੀ ਚਾਹੀਦਾ ਹੈਗਾ ਪਹਿਲਾਂ ਵਾਲੇ ਪੇਰੈਂਟਸ ਜਿਸ ਤਰ੍ਹਾਂ ਭਾਈ ਸਿੱਧੇ ਠੇਠ ਸੀਗੇ ਆਪਣੇ ਜਵਾਕਾਂ ਨੂੰ ਬਿੱਲੀ ਕੁੱਤਾ ਹੀ ਕਹੀ ਜਾਂਦੇ ਸੀ ਅੱਜ ਕੱਲ੍ਹ ਮੁੰਡੇ ਬਹੂਆਂ ਦਾ ਜਵਾਨ ਅੱਗੋ ਪੜ੍ਹੇ ਲਿਖੇ ਆ ਉਹ ਪਤੰਦਰ ਕੈਟ ਕੈਟੀ ਪਤਾ ਨਹੀਂ ਕੀ ਡੋਗੀ ਡੁਗੀ ਕੀ ਕੁਛ ਕਹਿੰਦੇ ਹੈਗੇ ਹੈਨਾ ਪਰ ਅਸੀਂ ਤਾਂ ਆਪਣੇ ਜਵਾਕਾਂ ਨੂੰ ਪੰਜਾਬੀ ਸਿਖਾਈ ਸੀ ਪਰ ਉਹ ਥੋੜ੍ਹਾ ਮੋਟਾ ਪੜ੍ਹ ਲਿਖ ਕੇ ਅਗਾਂਹ ਉਹਨਾਂ ਦੇ ਜਵਾਕ ਇੰਨੀ ਪੰਜਾਬੀ ਨਹੀਂ ਬੋਲਦੇ ਪਰ ਪੰਜਾਬੀ ਬਲੋ ਬੋਲਣੀ ਤਾਂ ਬਹੁਤ ਜ਼ਰੂਰੀ ਹੈਗੀ ਦਾਦੇ ਨੂੰ ਅੱਗੇ ਸਾ ਬਾਪੂ ਜਾਂ ਦਾ ਦਾਦਾ ਕਹਿੰਦੇ ਹੁੰਦੇ ਸੀਗੇ ਬਾਬਾ ਕਹਿੰਦੇ ਹੁਣ ਅੱਜ ਕੱਲ੍ਹ ਤਾਂ ਦਾਦੂ ਡੈਲਾ ਪਤਾ ਨਹੀਂ ਕੀ ਕੀ ਨਾਂ ਜਿਹੇ ਲੈਂਦੇ ਹੈਗੇ ਆਪ ਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਸਕੂਲਾਂ ਦੇ ਵਿੱਚ ਵੀ ਸਿਖਾਉਣੀ ਚਾਹੀਦੀ ਹੈ ਘਰ ਵੀ ਧਿਆਨ ਦੇਣਾ ਚਾਹੀਦਾ ਹੈਗਾ ਮਾਂ ਪਿਓ ਨੂੰ ਵੀ ਭਾਵੇਂ ਪੜ੍ਹ ਲਿਖ ਗਏ ਜੈਸਾ ਮੇਰਾ ਮੁੰਡਾ ਪੜ੍ਹਿਆ ਲਿਖਿਆ ਹੈ ਮੇਰੀ ਨੂੰਹ ਪੜ੍ਹੀ ਲਿਖੀ ਹੈ ਪਰ ਫਿਰ ਵੀ ਮੈਂ ਆਪਣੇ ਪੋਤੇ ਪੋਤੀਆਂ ਨੂੰ ਪੰਜਾਬੀ ਦੇ ਜਿਹੜੇ ਠੇਠ ਪੰਜਾਬੀ ਦੇ ਸ਼ਬਦ ਹੈਗੇ ਉਹ ਸਿਖਾਉਂਦਾ ਰਹਿੰਦਾ ਹੈਗਾ ਵੀ ਕਿਤੇ ਵੀ ਲੋੜ ਪੈ ਸਕਦੀ ਹੈ ਪੰਜਾਬੀ ਭਾਸ਼ਾ ਤਾਂ ਸਾਡੀ ਪਛਾਣ ਹੈਗੀ ਅਸੀਂ ਦੂਜੀਆਂ ਭਾਸ਼ਾਵਾਂ ਵੀ ਸਿੱਖੀਏ ਪਰ ਅਸੀਂ ਇਹਦੇ ਨਾਲੋਂ ਟੁੱਟਣਾ ਨਹੀਂ ਗਾ ਜਿਵੇਂ ਗੁਰਦਾਸ ਮਾਨ ਨੇ ਕਿਹਾ ਹੈ ਉਹ ਤਾਂ ਕਿੰਨਾ ਸੋਹਣਾ ਗੀਤ ਗਾਉਂਦਾ ਹੁੰਦਾ ਪੰਜਾਬੀਏ ਰਕਾਨੇ ਨੀ ਬੋਲੀ ਮੇਰੇ ਦੇਸ਼ ਦੀ ਇੱਦਾਂ ਦਾ ਕੁਛ ਪੰਜਾਬੀ ਭਾਸ਼ਾ ਦਾ ਜਿਹੜਾ ਸਾਨੂੰ ਸਿੱਖਾਉਣੀ ਚਾਹੀਦੀ ਆ ਸਾਰਿਆਂ ਨੂੰ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਧੰਨਵਾਦ ਜੀ